ਹੈਲੋ ਸਤਿ ਸ਼੍ਰੀ ਅਕਾਲ ਜੀ ਆ ਮੈਂ ਨਾ ਤਾਂ ਉਹਦੇ ਰੈਂਟ ਬਾਰੇ ਪੁੱਛਣਾ ਸੀ ਹਾਊਸ ਰੈਂਟ ਪ੍ਰੋਪਰਟੀ ਬਾਰੇ ਕਿ ਅੱਜ ਕੱਲ੍ਹ ਕੀ ਰੇਟ ਚੱਲਦਾ ਪਿਆ ਵਾ ਮੈਂ ਰੈਂਟ 'ਤੇ ਰਹਿਣਾ ਹਾਂਜੀ

ਹਾਂਜੀ ਜੇ ਅਲੱਗ ਅਲੱਗ ਰੂਮ ਪ੍ਰੋਵਾਈਡਡ ਹੋਣ

ਹਾਂਜੀ ਹਾਂਜੀ

ਹਾਂਜੀ ਅਤੇ ਇਹਦੀ ਜਗ੍ਹਾ ਕਿੱਥੋਂ ਹੋਈ ਹੈ ਜਗ੍ਹਾ ਬਾਰੇ ਕੋਈ ਨੌਲੇਜ

ਜਗ੍ਹਾ ਅਤੇ ਜਗ੍ਹਾ ਬਸ ਉੱਦਾਂ ਹੋਵੇ ਨਾ ਜਿੱਦਾਂ ਸਾਨੂੰ ਕੋਈ ਵੀ ਚੀਜ਼ ਸਮਾਨ ਵਗੈਰਾ ਲੈ ਕੇ ਵੀ ਬਾਹਰ ਜਾਣਾ ਪਵੇ ਤਾਂ ਉਹ ਨੇੜੇ ਹੋਵੇ ਜਿੱਦਾਂ ਸਕੂਲ ਹੋ ਗਿਆ ਕੋਈ ਦੁਕਾਨ

ਹਾਂਜੀ ਅਤੇ ਇਹਦਾ ਵੈਸੇ ਕਿਰਾਇਆ ਫਾਈਨਲੀ ਕਿੰਨਾ ਹੋ ਸਕਦਾ ਵਾ ਪੂਰੇ ਘਰ ਦਾ ਹਾਂ ਠੀਕ ਹੈ ਚਲੋ ਫਿਰ ਮੈਂ ਤੁਹਾਨੂੰ ਦੋ ਮਿੰਟਾਂ ਬਾਅਦ ਦੋ ਦਿਨਾਂ ਬਾਅਦ ਆ ਕੇ ਗੱਲ ਕਰਦੀ ਧੰਨਵਾਦ